ਸਮੇਂ ਦੇ ਨਾਲ ਪੰਜਾਬ ਦੇ ਭੂਗੋਲ ਵਿੱਚ ਕਾਫੀ ਬਦਲ ਆਇਆ ਹੈ ਸਿਰਫ ਪੰਜਾਬ 'ਚ ਨਹੀਂ ਪੂਰੇ ਭਾਰਤ ਵਿੱਚ ਹੀ ਕਾਫੀ ਫਰਕ ਆਇਆ ਹੈ ਜਿਵੇਂ ਕਿ ਕੁਦਰਤੀ ਆਫਤਾਂ ਹਨ ਜਿੱਦਾਂ ਪਹਿਲੇ ਗਰਮੀਆਂ ਦੇ ਵਿੱਚ ਤੂਫਾਨੀ ਝੱਖਰ ਨਹੀਂ ਸੀ ਆਉਂਦੇ ਗਰਮੀ ਹੁੰਦੀ ਸੀ ਲੇਕਿਨ ਇੰਨੇ ਕੁ ਤੂਫਾਨੀ ਝੱਖਰ ਨਹੀਂ ਸੀ ਆਉਂਦੇ ਹੁਣ ਤਿੰਨ ਚਾਰ ਸਾਲਾਂ ਤੋਂ ਇੰਨੀ ਕੁ ਝੱਖਰ ਆ ਰਹੇ ਹਨ ਕਿ ਪੇੜ ਪੌਦੇ ਟੁੱਟੇ ਜਾ ਰਹੇ ਹਨ ਵੱਡੇ ਵੱਡੇ ਦਰਖਤ ਜਿਹੜੇ ਇੰਨੇ ਇੰਨੇ ਸਾਲਾਂ ਤੋਂ ਖੜ੍ਹੇ ਸਨ ਉਹ ਟੁੱਟੇ ਜਾਂਦੇ ਆ ਜਿਸ ਕਾਰਨ ਸਾਡੇ ਭੂਗੋਲ 'ਚ ਕਾਫੀ ਫਰਕ ਆ ਰਿਹਾ ਹੈ ਪਹਿਲੇ ਸਰਦੀ ਵੀ ਕਾਫੀ ਲੰਬੇ ਤਾ ਕਾਲ ਤੱਕ ਹੁੰਦੀ ਸੀ ਕ ਪੈਂਦੀ ਕਾਫੀ ਕਾਲ ਤੱਕ ਸੀ ਲੇਕਿਨ ਹੁਣ ਤਾਂ ਸਰਦੀ ਪੈਂਦੀ ਇੱਕ ਡੇਢ ਮਹੀਨਾ ਹੈ ਲੇਕਿਨ ਬਹੁਤ ਜ਼ਿਆਦਾ ਪੈਂਦੀ ਹੈ ਅਤੇ ਬੰਦੇ ਨੂੰ ਯਾਦ ਕਰਾ ਦਿੰਦੀ ਹੈ ਕਿ ਹਾਂ ਸਰਦੀ ਪੈ ਰਹੀ ਹੈ ਇਹਨਾਂ ਦੇ ਕਾਰਨ ਵੀ ਮਨੁੱਖ ਦੀ ਆਪਣੀ ਹੀ ਹੈ ਕਿਉਂਕਿ ਅੱਜ ਕੱਲ੍ਹ ਲੋਕ ਪੇੜ ਕੱਟੀ ਜਾਂਦੇ ਦਰਖਤਾਂ ਨੂੰ ਕੱਟ ਕੱਟ ਕੇ ਉੱਥੇ ਘਰ ਬਣਾਈ ਜਾਂਦੇ ਜਿੱਦਾਂ ਜਿੱਦਾਂ ਵਸੋਂ ਵੱਧਦੀ ਜਾ ਰਹੀ ਹੈ ਸਾਡੇ ਭੂਗੋਲ ਵਿੱਚ ਕਾਫੀ ਚੇਂਜ ਆਈ ਜਾ ਰਿਹਾ ਹੈ ਇਹਦਾ ਦੂਸਰਾ ਕਾਰਨ ਸਾਡੇ ਦੇਸ਼ ਵਿੱਚ ਵੱਧ ਰਹੀ ਸਾਡੇ ਪੰਜਾਬ 'ਚ ਵੱਧ ਰਹੀ ਆਵਾਜਾਵੀ ਦੇ ਸਾਧਨ ਹਨ ਜਿਹਦੇ ਨਾਲ ਕਿ ਕਾਫੀ ਪੋਲਿਊਸ਼ਨ ਫੈਲ ਰਿਹਾ ਹੈ ਜਿਸ ਕਾਰਨ ਵੀ ਸਾਡੇ ਭੂਗੋਲ ਦੇ ਵਿੱਚ ਕਾਫੀ ਬਦਲਾਵ ਆ ਰਿਹਾ ਹੈ ਕਿਉਂਕਿ ਅੱਜ ਕੱਲ੍ਹ ਗਰਮੀ ਜੇ ਪੈਂਦੀ ਹੈ ਤਾਂ ਅੱਤ ਦੀ ਪੈਂਦੀ ਹੈ ਜੇ ਸਰਦੀ ਪੈਂਦੀ ਹੈ ਤਾਂ ਅੱਤ ਦੀ ਪੈਂਦੀ ਹੈ ਪਹਿਲੇ ਵੀ ਇੱਦਾਂ ਦਾ ਕੁਛ ਨਹੀਂ ਸੀ ਪਹਿਲੇ ਵੀ ਲੋਕ ਸਨ ਜਿਹੜੇ ਸਰਦੀ ਗਰਮੀ ਸਭ ਸਹਿੰਦੇ ਸਨ ਪਰ ਹੁਣ ਇਹ ਸਭ ਕੁਛ ਸਾਡੇ ਇਨਸਾਨਾਂ ਦੇ ਹੱਥ ਵਿੱਚ ਹੈ ਕਿਉਂਕਿ ਅਸੀਂ ਦਰਖਤਾਂ ਨੂੰ ਕੱਟ ਕੱਟ ਕੇ ਜ਼ਮੀਨ ਵੇਚੀ ਜਾ ਰਹੇ ਹਾਂ ਅਤੇ ਘਰ ਬਣਾਈ ਜਾ ਰਹੇ ਹਾਂ ਦੂਸਰਾ ਆਵਾਜਾਈ ਦੇ ਸਾਧਨ ਇੰਨੇ ਕੁ ਵੱਧ ਗਏ ਹੈ ਕਿ ਜਿਹਦੇ ਨਾਲ ਪਲਿਊਸ਼ਨ ਕਾਫੀ ਵੱਧੀ ਜਾ ਰਿਹਾ ਹੈ ਉਹ ਜਿਹੜਾ ਕਿ ਸਾਡੇ ਭੂਗੋਲ ਨੂੰ ਕਾਫੀ ਬਦਲਾਵ ਕਰ ਰਿਹਾ ਹੈ ਅਤੇ ਸਾਡੇ ਭੂਗੋਲ ਦੇ ਵਿੱਚ ਕਾਫੀ ਚੇਂਜ ਆ ਰਹੇ ਆ